ਖੇਡਾਂ ਖੇਡਾਂ ਅਸੀਂ ਸਾਰੇ ਛੋਟੇ ਹੁੰਦੇ ਤੋਂ ਲੈ ਕੇ ਆਪਣੀ ਜਵਾਨੀ ਪਹਿਰੇ ਤੱਕ ਅਸੀਂ ਖੇਡਾਂ ਖੇਡਦੇ ਆਉਂਦੇ ਹਾਂ ਕਈ ਬਚਪਨ ਵਿੱਚ ਅਸੀਂ ਛੋਟੀਆਂ ਮੋਟੀਆਂ ਖੇਡਦਾ ਖੇਡਦੇ ਹਾਂ ਅਤੇ ਜਵਾਨੀ ਪੈਰੇ ਵਿੱਚ ਆਉਂਦੇ ਆਉਂਦੇ ਕਈ ਤਾਂ ਹੁੰਦੀਆਂ ਨੂੰ ਖੇਡਾਂ ਵਿੱਚ ਚੰਗੀ ਮੁਹਾਰਤ ਕਰ ਲੈਂਦੇ ਹਨ ਅਤੇ ਬਹੁਤ ਹੀ ਅੱਛੀਆਂ ਖੇਡਾਂ ਖੇਡਣੀਆਂ ਸ਼ੁਰੂ ਕਰ ਦਿੰਦੇ ਹਨ ਵੱਡੇ ਵੱਡੇ ਲੈਵਲ 'ਤੇ ਖੇਡਾਂ ਜਿਹੜੀਆਂ ਕਿ ਸਾਡੇ ਲੋਕਾਂ ਲਈ ਸਟਰੈਸ ਰਹਿਤ ਹਨ ਅਤੇ ਆਨੰਦਾਇਕ ਹਨ ਕਿ ਅਸੀਂ ਕਿਵੇਂ ਕਹਿ ਸਕਦੇ ਹਨ ਅਸੀਂ ਖੁਦ ਹੀ ਕਹਿ ਸਕਦੇ ਹਾਂ ਕਿ ਖੇਡਾਂ ਸਾਡੇ ਲਈ ਸਟਰੈਸ ਰਹਿਤ ਹਨ ਕਿਉਂਕਿ ਜਦੋਂ ਕੋਈ ਵਿਅਕਤੀ ਖੇਡਾਂ ਖੇਡਦਾ ਹੈ ਤਾਂ ਉਹ ਆਪਣੀਆਂ ਸਾਰੀਆਂ ਚਿੰਤਾਵਾਂ ਨੂੰ ਦੂਰ ਕਰ ਦਿੰਦਾ ਹੈ ਅਤੇ ਸਿਰਫ਼ ਖੇਡ ਵੱਲ ਧਿਆਨ ਦਿੰਦਾ ਹੈ ਅਤੇ ਜਿਹੜਾ ਉਸਦਾ ਧਿਆਨ ਹੈ ਅਤੇ ਆਟੋਮੈਟਿਕ ਹੀ ਉਸਦੀ ਜਿਹੜੀ ਕਿ ਮਨ ਦੀ ਇੱਛਾ ਹੈ ਉਹ ਚੰਗੀ ਹੋ ਜਾਂਦੀ ਹੈ ਅਤੇ ਖੇਡਾਂ ਸਾਨੂੰ ਆਨੰਦ ਵੀ ਦਿੰਦੀਆਂ ਹਨ ਖੇਡਾਂ ਸਾਡੀ ਥਕਾਵਟ ਨੂੰ ਵੀ ਦੂਰ ਕਰਦੀਆਂ ਕਿਵੇਂ ਕਰਦੀਆਂ ਹਨ ਕਿਵੇਂ ਕਰਦੀਆਂ ਹਨ ਜਦੋਂ ਕੋਈ ਬੰਦਾ ਖੇਡਦਾ ਹੈ ਉਸਨੂੰ ਥਕਾਵਟ ਹੁੰਦੀ ਹੈ ਉਹ ਥੱਕਦਾ ਹੈ ਅਤੇ ਉਸਨੂੰ ਰਾਤ ਨੂੰ ਚੰਗੀ ਨੀਂਦ ਵੀ ਆਉਂਦੀ ਹੈ ਖੇਡਾਂ ਖੇਡਣ ਨਾਲ ਸਾਡਾ ਸਰੀਰ ਸ਼ੁਡੌਲ ਬਣਦਾ ਹੈ ਜਦੋਂ ਸਾਡਾ ਸਰੀਰ ਸ਼ੁਡੌਲ ਹੋਵੇਗਾ ਸਾਨੂੰ ਕੋਈ ਵੀ ਬਿਮਾਰੀ ਨਹੀਂ ਹੋਵੇਗੀ ਤਾਂ ਆਟੋਮੈਟਿਕ ਜਿਹੜੀ ਸਾਡੀ ਸਿਹਤ ਹੈ ਸਾਡੀ ਜ਼ਿੰਦਗੀ ਹੈ ਉਹ ਆਨੰਦਦਾਇਕ ਬਤੀਤ ਹੋਵੇਗੀ ਖੇਡਾਂ ਖੇਡਣ ਨਾਲ ਸਾਡੇ ਜੀਵਨ ਵਿੱਚ ਹੋਰ ਵੀ ਬਹੁਤ ਸਾਰੇ ਲਾਭ ਹੁੰਦੇ ਹਨ ਕਈ ਖੇਡਾਂ ਖੇਡਦੇ ਖੇਡਦੇ ਇੰਨੀਆਂ ਵਧੀਆਂ ਖੇਡਾਂ ਖੇਡਣੀਆਂ ਸ਼ੁਰੂ ਕਰ ਦਿੰਦੇ ਹਨ ਕਿ ਉਹ ਵੱਡੇ ਲੈਵਲ ਉੱਤੇ ਖੇਡਾਂ ਸ਼ੁਰੂ ਕਰ ਦਿੰਦੇ ਹਨ ਅਤੇ ਖੇਡਦੇ ਖੇਡਦੇ ਬਹੁਤ ਹੀ ਜ਼ਿਆਦਾ ਅੱਗੇ ਨਿਕਲ ਜਾਂਦੇ ਹਨ ਤੁਸੀਂ ਸਾਰਿਆਂ ਨੇ ਬਹੁਤ ਸਾਰੇ ਪਲੇਅਰਾਂ ਬਾਰੇ ਸੁਣਿਆ ਹੋਵੇਗਾ ਜਿਵੇਂ ਵਿਰਾਟ ਕੋਹਲੀ ਧੋਨੀ ਇਹ ਸਾਰੇ ਹਨ ਇਹ ਖੇਡਾਂ ਖੇਡ ਕੇ ਹੀ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਰਿਹਾ ਖੇਡਾਂ ਦੇ ਨਾਲ ਅਗਲੇ ਖੇਡਦੇ ਵੀ ਹਨ ਅਤੇ ਪੈਸਾ ਵੀ ਕਮਾ ਰਹੇ ਹਨ ਸਾਨੂੰ ਪਤਾ ਹੈ ਹਰ ਸਾਲ ਆਈ ਪੀ ਐਲ ਹੁੰਦਾ ਹੈ ਇਸ ਸਾਲ ਵੀ ਦੋ ਹਜ਼ਾਰ ਚੌਵੀ ਦਾ ਆਈ ਪੀ ਐਲ ਚੱਲ ਰਿਹਾ ਅਤੇ ਇਹਦੇ ਵਿੱਚ ਬਹੁਤ ਸਾਰੇ ਪਲੇਅਰ ਖੇਡਦੇ ਹਨ ਆਈ ਪੀ ਐਲ ਵਿੱਚੋਂ ਖੇਡ ਖੇਡ ਪ੍ਰਦਰਸ਼ਨ ਦਿਖਾ ਕੇ ਹੀ ਪੈਸਾ ਕਮਾ ਰਹੇ ਹਨ ਇੱਦਾਂ ਕੋਈ ਵੀ ਪਲੇਅਰ ਹੈ ਖੇਡਾਂ ਖੇਡ ਕੇ ਆਪਣੀ ਜੋ ਘਰ ਦੀ ਰੋਜੀ ਰੋਟੀ ਕਰ ਰਿਹਾ ਹੈ ਖੇਡਾਂ ਦੇ ਨਾਲ ਨਾਲ ਬੰਦਾ ਬਹੁਤ ਕੁਝ ਸਿੱਖਦਾ ਹੈ ਬੰਦੇ ਨੂੰ ਅਨੁਸ਼ਾਸਨ ਆਉਂਦਾ ਹੈ ਬੰਦੇ ਨੂੰ ਸ਼ਹਿਣਸ਼ੀਲਤਾ ਦੀ ਭਾਵਨਾ ਆਉਂਦੀ ਹੈ ਲੋਕ ਬਹੁਤ ਕੁਝ ਸਿੱਖਦੇ ਹਨ ਇਹਨਾਂ ਖੇਡਾਂ ਤੋਂ ਖੇਡਾਂ ਇਹ ਹੀ ਨਹੀਂ ਕਿ ਸਾਡਾ ਸਰੀਰਿਕ ਖੇਡਾਂ ਸਾਡਾ ਸਰੀਰਿਕ ਮਾਨਸਿਕ ਅਤੇ ਸਰੀਰਿਕ ਤੌਰ 'ਤੇ ਵਿਕਾਸ ਕਰਦੀਆਂ ਹਨ ਖੇਡਾਂ ਸਾਡੇ ਜੀਵਨ ਲਈ ਇੰਨੀਆਂ ਜ਼ਿਆਦਾ ਲਾਭਦਾਇਕ ਹੁੰਦੀਆਂ ਇਹਨਾਂ ਖੇਡਾਂ ਨਾਲ ਅਸੀਂ ਆਪਣੀ ਜ਼ਿੰਦਗੀ ਸਫਲ ਬਣਾ ਸਕਦੇ ਹਨ ਖੇਡਾਂ ਸਾਡੇ ਸਰੀਰ ਨੂੰ ਨਿਰਗੁਣ ਗੁਣ ਪ੍ਰਦਾਨ ਕਰਦੀਆਂ ਹਨ ਅਤੇ ਨਿਰੋਗ ਰਹਿਤ ਜੋ ਰੋਗ ਹੈ ਰੋਗ ਰਹਿਤ ਬਣਾਉਂਦੀਆਂ ਹਨ ਖੇਡਾਂ ਸਾਡੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਸਿੱਧ ਹੁੰਦੀਆਂ ਹਨ ਇਹ ਹੀ ਕਹਿਣਾ ਚਾਹੁੰਦਾ ਕਿ ਜੋ ਖੇਡਾਂ ਲੋਕਾਂ ਲਈ ਉਹ ਸਟਰੈਸ ਰਹਿਤ ਅਤੇ ਆਨੰਦਾਇਕ ਆਊਟਲਾਈਨ ਪ੍ਰਦਾਨ ਕਰਦੀਆਂ ਹਨ ਕਿਉਂਕਿ ਜੇਕਰ ਅਸੀਂ ਇਵੇਂ ਹੀ ਖੇਡਦੇ ਰਹਿੰਦੇ ਹਾਂ ਤਾਂ ਇੱਕ ਨਾ ਇੱਕ ਦਿਨ ਅਸੀਂ ਬਹੁਤ ਹੀ ਵੱਡੇ ਮੁਕਾਮ 'ਤੇ ਪਹੁੰਚ ਜਾਂਦੇ ਹਾਂ ਅਤੇ ਅਸੀਂ ਪੈਸੇ ਵੀ ਕਮਾਉਣੇ ਸ਼ੁਰੂ ਕਰ ਦਿੰਦੇ ਹਾਂ ਤੁਸੀਂ ਸਾਰੇ ਬਹੁਤ ਸਾਰੇ ਪਲੇਅਰਾਂ ਨੂੰ ਦੇਖਦੇ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਵਿਰਾਟ ਕੋਹਲੀ ਐਮ ਐਸ ਧੋਨੀ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕ੍ਰਿਸਟਾਨੋ ਰੋਨਾਲਡੋ ਮੈਸੀ ਵਗੈਰਾ ਇਹ ਸਾਰੇ ਹੀ ਖੇਡਾਂ ਖੇਡ ਕੇ ਹੀ ਆਪਣੀ ਜੋ ਜ਼ਿੰਦਗੀ ਬਤੀਤ ਕਰ ਰਹੇ ਹਨ